ਸੈਲਫ ਹੈਲਪ ਗਰੁੱਪ ਆਮ ਤੌਰ 'ਤੇ ਦਸ ਵੀਹ ਸਥਾਨਕ ਔਰਤਾਂ ਜਾਂ ਲੋਕਾਂ ਦੀ ਬਣੀ ਇੱਕ ਪਿੰਡ ਅਧਾਰਿਤ ਵਿੱਤੀ ਵਿਚੋਲੋ ਕਮੇਟੀ ਹੈਗੀ ਖਾਸ ਕਰਕੇ ਦੱਖਣੀ ਏਸ਼ੀਆ ਅਤੇ ਦੱਖਣ ਪੂਰਵੀ ਏਸ਼ੀਆ ਵਿੱਚ ਹੋਰ ਦੇਸ਼ ਵਿੱਚ ਪਾਇਆ ਗਿਆ ਪਰ ਜ਼ਿਆਦਾਤਰ ਸਵੈ ਮਦਦ ਗਰੁੱਪ ਭਾਰਤ ਵਿੱਚ ਹੀ ਹੈ ਕੁਝ ਔਰਤਾਂ ਦੁਆਰਾ ਇਹ ਗਰੁੱਪ ਬਣਾਇਆ ਗਿਆ ਜੋ ਮਿਲ ਕੇ ਕੰਮ ਕਰੇ ਜਾਂ ਕਿਸੇ ਖਾਣ ਵਾਲੀ ਵਸਤੂ ਦਾ ਉਤਪਾਦਨ ਕਰੇ ਅਤੇ ਆਪ ਵੇਚੇ ਜਿਹਨਾਂ ਵਿੱਚ ਔਰਤਾਂ ਅਚਾਰ ਬਣਾ ਰਹੀਆਂ ਹਨ ਟੋਪੀਆਂ ਬੁਣ ਰਹੀਆਂ ਹਨ ਜਾਕਟਾਂ ਬੁਣ ਰਹੀਆਂ ਹਨ ਸਵੈਟਰ ਬੁਣ ਰਹੀਆਂ ਹਨ ਜਾਂ ਹੋਰ ਕੋਈ ਵੀ ਕੰਮ ਛੋਟੇ ਮੋਟੇ ਕੰਮ ਲਘੂ ਕੰਮ ਕਰ ਰਹੇ ਹਨ ਘਰ ਬਹਿ ਕੇ ਮੋਮਬੱਤੀਆਂ ਬਣਾਉਣ ਦਾ ਕੰਮ ਇਹਨਾਂ ਨਾਲ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਹਨ ਕਮੇਟੀ ਪਾਉ ਬਣਾਉਣ ਤੋਂ ਬਾਅਦ ਮਤਾ ਪਾ ਕੇ ਇਸ ਗਰੁੱਪ ਦੀ ਮਾਨਤਾ ਵੀ ਲਈ ਜਾਂਦੀ ਹੈ ਪੰਜਾਬ ਦੇ ਕੁਝ ਗਰੁੱਪ ਆਰਟ ਵਾਸਤੇ ਹੁੰਦੇ ਆ ਤਾਂ ਜੋ ਉਹ ਕੁਛ ਕੁਛ ਨਵੀਆਂ ਨਵੀਆਂ ਚੀਜ਼ਾਂ ਬਣਾ ਕੇ ਉਹ ਬਾਜ਼ਾਰ ਵਿੱਚ ਭੇਜਦੇ ਹਨ ਅਤੇ ਇਹਨਾਂ ਪੰਜਾਬ ਦੇ ਕੁਝ ਗਰੁੱਪਾਂ ਨੂੰ ਆਰਟ ਕਰਾਫਟ ਸੈਲਫ ਹੈਲਪ ਟ੍ਰੇਨਿੰਗ ਸੁਸਾਇਟੀ ਪੰਜਾਬ ਵੱਲੋਂ ਦਿੱਤੀ ਜਾਂਦੀ ਟ੍ਰੇਨਿੰਗ ਹੈ ਉਸਤਾਦ ਨਵੇਂ ਨਵੇਂ ਕੇਂਦਰ ਖੋਲੇ ਜਾਂਦੇ ਤਾਂ ਜੋ ਨਵੀਆਂ ਨਵੀਆਂ ਟ੍ਰੇਨਿੰਗਾਂ ਦੇ ਕੇ ਨਵੇਂ ਨਵੇਂ ਤਜਰਬੇ ਦਿੱਤੇ ਜਾਣ ਇਹਨਾਂ ਵਿੱਚ ਸਲਾਈ ਕਢਾਈ ਦੀ ਟ੍ਰੇਨਿੰਗ ਵੀ ਇੱਕ ਅਹਿਮ ਹਿੱਸਾ ਹੈ ਅਤੇ ਔਰਤਾਂ ਨੂੰ ਇਹ ਟ੍ਰੇਨਿੰਗ ਦੇ ਕੇ ਨਵਾਂ ਉਦਯੋਗ ਸ਼ੁਰੂ ਕੀਤਾ ਜਾਂਦਾ ਹੈ ਅਤੇ ਸੈਲਫ ਹੈਲਪ ਗਰੁੱਪ ਇਹਦੇ ਸਾਲ ਦੇ ਜਿਹੜਾ ਅੰਤ ਆ ਇਹਦੇ ਵਿੱਚ ਇਹਦਾ ਮੁਨਾਫਾ ਵੰਡਿਆ ਗਿਆ ਅਤੇ ਵੰਡਿਆ ਮੁਨਾਫਾ ਸਭ ਨੂੰ ਬਰਾਬਰ ਗਿਆ ਹੈ ਅਤੇ ਸਭ ਦਾ ਹਿੱਸਾ ਬਰਾਬਰ ਮਿਲਿਆ ਪਿੰਡਾਂ ਵਿੱਚ ਆਂਗਣਵਾੜੀ ਕੇਂਦਰ ਵੀ ਖੋਲੇ ਗਏ ਜਿਹਨਾਂ ਵਿੱਚ ਸੈਲਫ ਹੈਲਪ ਗਰੁੱਪ ਰਾਹੀਂ ਪੇਂਡੂ ਅਤੇ ਘਰੇਲੂ ਔਰਤਾਂ ਨੂੰ ਵੱਡੀ ਇੱਕ ਰਾਹਤ ਦੇਖਣ ਨੂੰ ਮਿਲੀ ਅਤੇ ਔਰਤਾਂ ਥੋੜ੍ਹੀ ਜਿਹੀ ਰਾਸ਼ੀ ਪ੍ਰਤੀ ਮਹੀਨਾ ਖਰਚ ਕੇ ਆਪਣੀ ਮਦਦ ਆਪ ਕਰ ਸਕਦੀਆਂ ਅਤੇ ਆਪਣੇ ਪਰਿਵਾਰ ਦਾ ਜਿਹੜਾ ਢਿੱਡ ਉਹ ਭਰ ਸਕਦੀਆਂ ਅਤੇ ਆਪਣੇ ਲਈ ਇੱਕ ਰਾਸ਼ੀ ਜੋੜ ਸਕਦੀਆਂ ਤਾਂ ਜੋ ਉਹਨਾਂ ਵਾਸਤੇ ਆਉਣ ਵਾਲੇ ਸਮੇਂ ਵਿੱਚ ਉਹ ਕੰਮ ਆ ਸਕੇ ਅਤੇ ਸੈਲਫ ਹੈਲਪ ਗਰੁੱਪ ਵੱਲੋਂ ਤਿਆਰ ਕੀਤੀਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਜਾਂਦੀਆਂ ਹਨ ਇਹਨਾਂ ਦੀ ਪ੍ਰਦਰਸ਼ਨ ਦੀ ਕੀਮਤ ਉਹਨਾਂ ਦੇ ਆਧਾਰ 'ਤੇ ਪਾਈ ਜਾਂਦੀ ਹੈ ਇਸ ਨਾਲ ਗਰੁੱਪ ਦੀਆਂ ਬਣਾਈਆਂ ਹੋਈਆਂ ਵਸਤੂਆਂ ਨੂੰ ਵੇਚ ਦਿੱਤਾ ਗਿਆ ਅਤੇ ਜਾਂਦਾ ਸੈਲਫ ਹੈਲਪ ਗਰੁੱਪ ਨੂੰ ਆਪਣੇ ਸਵੈਰੁਜ਼ਗਾਰ ਧੰਦੇ ਸ਼ੁਰੂ ਕਰਨ ਵਾਸਤੇ ਮੰਨਿਆ ਜਾਂਦਾ ਹੈ ਜਿੱਥੇ ਆਪਣੇ ਲਈ ਕੰਮ ਸ਼ੁਰੂ ਕਰਦੇ ਹਨ ਉੱਥੇ ਹੋਰਾਂ ਲਈ ਵੀ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਂਦੇ ਤਾਂ ਜੋ ਇਹ ਹੋਰਾਂ ਨੂੰ ਵੀ ਰੁਜ਼ਗਾਰ ਦਾ ਮੌਕਾ ਪੈਦਾ ਕਰ ਸਕੇ ਉਹਨਾਂ ਦਾ ਵੀ ਪਰਿਵਾਰ ਵਧੀਆ ਤਰੀਕੇ ਨਾਲ ਪਲ ਸਕੇ ਇਹਨਾਂ ਤਰੀਕਿਆਂ ਨਾਲ ਸਵੈ ਰੁਜ਼ਗਾਰ ਧੰਦਿਆਂ ਲਈ ਨਾਬਾਰਡ ਵੱਲੋਂ ਸਿਖਲਾਈ ਕੈਂਪ ਵੀ ਲਗਾਏ ਜਾਂਦੇ ਹਨ ਸੈਲਫ ਹੈਲਪ ਗਰੁੱਪ ਇਹਨਾਂ ਨੂੰ ਨਵੀਆਂ ਨਵੀਆਂ ਯੋਜਨਾਵਾਂ ਤਿਆਰ ਕਰਕੇ ਦਿੰਦਾ ਹੈ ਤਾਂ ਜੋ ਨਵੇਂ ਨਵੇਂ ਤਰੀਕੇ ਅਤੇ ਨਵੇਂ ਨਵੀਆਂ ਕਾਢਾ ਲੈ ਕੇ ਨਵੇਂ ਨਵੇਂ ਛੋਟੇ ਲਘੂ ਉਦਯੋਗ ਸਥਾਪਿਤ ਕਰਕੇ ਇਹਨਾਂ ਬਾਰੇ ਤਰੱਕੀ ਹੋਰ ਹੋ ਸਕੇ